ਪੰਜਾਬ ਵਿੱਚ ਕੁਝ ਪ੍ਰਮੁੱਖ ਖੇਡ ਸਥਾਨ ਹਨ ਜੋ ਖੇਡਾਂ ਦੇ ਸਮਾਗਮਾਂ ਅਤੇ ਟੂਰਨਾਮੈਂਟਾਂ ਦੀ ਮੇਜ਼ਬਾਨੀ ਕਰਦੇ ਹਨ ਕਿਲ੍ਹਾ ਰਾਏਪੁਰ ਸਟੇਡੀਅਮ ਇਹ ਸਟੇਡੀਅਮ ਪੰਜਾਬ ਵਿੱਚ ਲੋਕਾਂ ਦੀ ਪਸੰਦੀਦਾ ਹੈ ਅਤੇ ਇੱਥੇ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ ਸੰਧੂ ਸਟੇਡੀਅਮ ਇਹ ਸਟੇਡੀਅਮ ਅੰਮ੍ਰਿਤਸਰ ਵਿੱਚ ਸਥਿੱਤ ਹੈ ਅਤੇ ਕ੍ਰਿਕਟ ਦੇ ਖੇਡਾਂ ਲਈ ਮਹਾਨ ਸਥਾਨ ਹੈ ਗੁਰੂ ਨਾਨਕ ਸਟੇਡੀਅਮ ਇਹ ਸਟੇਡੀਅਮ ਅੰਮ੍ਰਿਤਸਰ ਵਿੱਚ ਹੀ ਸਥਿੱਤ ਹੈ ਅਤੇ ਕਈ ਖੇਡਾਂ ਦਾ ਇੱਥੇ ਆਯੋਜਨ ਹੁੰਦਾ ਹੈ ਜਿਵੇਂ ਕਿ ਹਾਕੀ ਫੁੱਟਬਾਲ ਅਤੇ ਅਖਾੜੇ ਇਹ ਥਾਵਾਂ ਪੰਜਾਬ ਵਿੱਚ ਖੇਡ ਅਤੇ ਖੇਡਾਂ ਦੇ ਉਤਸਵਾਂ ਦੇ ਲਈ ਮੁੱਖ ਰੱ ਮੰਨੀਆਂ ਜਾਂਦੀਆਂ ਹਨ